ਭੰਗੜਾ ਐਰੋਬਿਕਸ ਦੇ ਨਾਲ ਮਾਨਸਿਕ ਸਿਹਤ ਅਤੇ ਭਾਵਨਾਤਮਕ ਤੰਦਰੁਸਤੀ ਨੂੰ ਉਤਸ਼ਾਹਤ ਕਰਨ ਦੇ ਕਈ ਤਰੀਕੇ ਆ ਇਵੇਂ ਸਰਗਰਮੀਆਂ ਤੇ ਵਿਸ਼ਰਾਮ ਭੰਗੜਾ ਐਰੋਬਿਕਸ ਲੋਕਾਂ ਨੂੰ ਸਰੀਰਕ ਤੰਦਰੁਸਤੀ ਪ੍ਰਦਾਨ ਕਰਦਾ ਜਿਸ ਨਾਲ ਐਰੋਫਿਨ ਜਾਨੀ ਕਿ ਜਿਸ ਨੂੰ ਖੁਸ਼ੀ ਦੇ ਹਾਰਮੋਨ ਕਿਹਾ ਜਾਂਦਾ ਹੈ ਉਹ ਉਤਪਾਦਨ ਹੁੰਦੇ ਹਨ ਇਹ ਮਾਨਸਿਕ ਵਿਸ਼ਰਾਮ ਅਤੇ ਚਿੰਤਾ ਦੀ ਘਟਾਵਟ ਵਿੱਚ ਮਦਦ ਕਰ ਸਕਦਾ ਹੈ ਭੰਗੜਾ ਨੱਚਣਾ ਜਾਂ ਭੰਗੜਾ ਐਰੋਬਿਕਸ ਤੇ ਟੀਚੇ ਦੀ ਭਾਗੀਦਾਰੀ ਲੋਕਾਂ ਨੂੰ ਇਕੱਠੇ ਕਰਨ ਅਤੇ ਸੰਬਾਜਿਕ ਸੰਪਰਕ ਨੂੰ ਮਜਬੂਤ ਕਰਨ ਵਿੱਚ ਕਰਦੀ ਹੈ ਸਮੂਹ ਵਿੱਚ ਰਹਿਣਾ ਨਾਲ ਮਨੁੱਖ ਮਨੁੱਖੀ ਸਬੰਧਾ ਅਤੇ ਭਰੋਸੇ ਦਾ ਵਿਕਾਸ ਹੁੰਦਾ ਹੈ ਸੰਗੀਤ ਅਤੇ ਰਿਦਮ ਭੰਗੜਾ ਦੇ ਮਸਤ ਭਰੇ ਸੰਗੀਤ ਅਤੇ ਰਿਦਮ ਨਾਲ ਭਾਵਨਾਵਾਂ ਦੀਆਂ ਅਭੀਵਿਧੀਆਂ ਨੂੰ ਉਤਸਾਹਿਤ ਕੀਤਾ ਜਾ ਸਕਦਾ ਏ ਇਹ ਮਨ ਨੂੰ ਭਰਪੂਰ ਅਤੇ ਉਤਸਾਹਿਤ ਕਰਦਾ ਹੈ ਜਿਸ ਨਾਲ ਮਨੋਭਾਵਨਾਵਾਂ ਵਿੱਚ ਸੁਧਾਰ ਹੁੰਦਾ ਹੈ ਭੰਗੜਾ ਸਿੱਖਣਾ ਨਵੇਂ ਨੱਚਣ ਦੇ ਆਸਾਨ ਕਦਮਾਂ ਨੂੰ ਸਿੱਖਣਾ ਮਨ ਨੂੰ ਚੁਣੌਤੀ ਅਤੇ ਕੰਮਾਂ ਲਈ ਤਿਆਰ ਕਰਨ ਦੇਣ ਦੇ ਹਿਸਾਬ ਨਾਲ ਕੀਤਾ ਜਾਂਦਾ ਹੈ ਇਹ ਮਾਵਾਦਾਰਤਾ ਨੂੰ ਵਧਾਉਂਦਾ ਹੈ ਅਤੇ ਵਿਅਕਤੀ ਨੂੰ ਆਪਣੇ ਆਪ ਤੇ ਭਰੋਸਾ ਕਰਨ ਦਾ ਮੌਕਾ ਦਿੰਦਾ ਭੰਗੜਾ ਪਾਉਣ ਨਾਲ ਵੇਟ ਲੋਸ ਹੁੰਦਾ ਜਿਸ ਨਾਲ ਆਦਮੀ ਫਿਟ ਤੇ ਤੰਦਰੁਸਤ ਬਣਦਾ ਹੈ ਭੰਗੜਾ ਪਾਉਣ ਨਾਲ ਜੋ ਪਸੀਨਾ ਆਉਂਦਾ ਹੈ ਉਸ ਨਾਲ ਆਦਮੀ ਦੇ ਸਰੀਰ ਵਿੱਚੋਂ ਵੱਖ ਵੱਖ ਤਰਹਾਂ ਦੇ ਫਾਲਤੂ ਪਦਾਰਥ ਬਾਹਰ ਨਿਕਲ ਜਾਂਦੇ ਹਨ ਭੰਗੜਾ ਪਾਉਣ ਨਾਲ ਬੰਦਾ ਇੱਕ ਤਾਂ ਫਿਟ ਰਹਿੰਦਾ ਹੈ ਦੂਜਾ ਉਸਦੇ ਮਨੋਰੰਜਨ ਦਾ ਇੱਕ ਵਧੀਆ ਸਾਧਨ ਭੰਗੜਾ ਪੇਸ਼ ਹੁੰਦਾ ਹੈ ਕਈ ਲੋਕ ਤਾਂ ਭੰਗੜਾ ਪਾਉਣ ਦੇ ਵਿੱਚ ਬਹੁਤ ਹੀ ਆਨੰਦ ਮਹਿਸੂਸ ਕਰਦੇ ਹਨ ਇਸ ਨਾਲ ਸਾਰੇ ਸਰੀਰ ਦੀ ਥਕਾਵਟ ਨਿਕਲ ਜਾਂਦੀ ਹੈ ਭੰਗੜਾ ਪੰਜਾਬੀ ਗੱਭਰੂਆਂ ਦੀ ਮਨ ਪਸੰਦ ਦੀ ਨਾਚ ਹੈ ਉਹ ਹਰ ਇਕ ਵਿਆਹ ਤਿਉਹਾਰਾਂ ਦੇ ਮੌਕਿਆਂ ਤੇ ਪਾਉਣਾ ਇਸ ਨੂੰ ਪਸੰ ਪਸੰਦ ਕਰਦੇ ਹਨ ਨਿਤ ਦਾ ਅਸਰ ਗਰਮ ਰਹਿਣਾ ਜੋ ਭੰਗੜੇ ਵਿੱਚ ਹੁੰਦਾ ਹੈ ਮਨੋਵਿਗਿਆਨਿਕ ਸਹਿਤ ਲਈ ਸਮਾਨ ਸਮਾਨਤਾਵਾਦੀ ਹੁੰਦਾ ਹੈ ਇਹ ਸਰੀਰ ਨੂੰ ਫਿਟ ਰੱਖਣ ਨਾਲ ਸਮੁੰਦਰ ਪੱਧਰ ਦੇ ਭਾਵਨਾਵਾਂ ਨੂੰ ਵੀ ਸਮ ਸਮ ਤੋਲੇ ਕਰਦਾ ਹੈ ਇਸ ਤਰਾਂ ਭੰਗੜਾ ਐਰੋਬਿਕਸ ਨੂੰ ਇੱਕ ਉੱਤਮ ਸਾਧਨ ਵਜੋਂ ਵਰਤਿਆ ਜਾ ਸਕਦਾ ਹੈ ਜੋ ਮਾਨਸਿਕ ਅਤੇ ਭਾਵਨਾਤਮਕ ਤੰਦਰੁਸਤੀ ਨੂੰ ਉਤਸ਼ਾਹਿਤ ਕਰਦਾ ਹੈ